ਆਮ ਤੌਰ 'ਤੇ ਸਾਡੇ ਖੇਤਰ ਵਿੱਚ ਐਨੇ ਮਸ਼ਹੂਰ ਸਿਨੇਮਾ ਥੀਏਟਰ ਨਹੀਂ ਹਨ ਪਰ ਸਾਡੇ ਇਲਾਕੇ ਦੇ ਨੇੜੇ ਮੋਰਿੰਡਾ ਅਤੇ ਜਿਲ੍ਹਾ ਰੂਪਨਗਰ ਦੇ ਵਿੱਚ ਕੁਝ ਸਿਨੇਮਾ ਥੀਏਟਰ ਹਨ ਜਿੱਥੇ ਲੋਕ ਆਮ ਤੌਰ 'ਤੇ ਸ਼ਨੀਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮਾਂ ਦੇਖਣ ਜਾਂਦੇ ਹਨ ਅਤੇ ਆਪਣਾ ਐਨਟਰਟੇਨਮੈਂਟ ਕਰਦੇ ਹਨ ਮੈਂ ਇੱਕ ਦੋ ਵਾਰ ਸਿਨੇਮਾ ਥੀਏਟਰ ਵਿੱਚ ਫਿਲਮ ਦੇਖਣ ਗਈ ਸੀ ਪਰ ਜਦੋਂ ਸਾਡਾ ਸਕੂਲ ਸਾਨੂੰ ਕੁਝ ਮਹੱਤਵਪੂਰਨ ਅਤੇ ਅਤੇ ਇਤਿਹਾਸਿਕ ਫਿਲਮਾਂ ਦਿਖਾਉਣ ਲੈ ਕੇ ਗਿਆ ਸੀ ਕਿਉਂਕਿ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਦੇ ਕੰਮਾਂ ਕਾਰਾਂ 'ਚ ਰੁੱਝਿਆ ਰਹਿਣ ਕਰਕੇ ਹੁਣ ਸਾਨੂੰ ਵਿਹਲ ਨਹੀਂ ਹੈ ਕਿ ਅਸੀਂ ਸਿਨੇਮਾ ਥੀਏਟਰ ਵਿੱਚ ਜਾ ਕੇ ਫਿਲਮ ਦੇਖ ਸਕੀਏ ਪਰ ਜਦ ਵੀ ਸਾਨੂੰ ਕਦੇ ਇਹੋ ਜਿਹਾ ਮੌਕਾ ਮਿਲਿਆ ਤਾਂ ਅਸੀਂ ਉਹ ਮੌਕਾ ਜ਼ਰੂਰ ਲਵਾਂਗੇ ਅਤੇ ਕਿਉਂਕਿ ਇਹ ਇੱਕ ਬਹੁਤ ਹੀ ਵਧੀਆ ਜਗ੍ਹਾ ਹੁੰਦੀ ਹੈ ਜਿਸ ਵਿੱਚ ਅਸੀਂ ਜਿਸ ਥਾਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਤੀਤ ਕਰ ਸਕਦੇ ਹਾਂ ਅਤੇ ਇੱਕ ਨਵੀਂ ਯਾਦਗਾਰ ਜੋੜ ਸਕਦੇ ਹਾਂ